ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਉੱਚੇ ਪੱਧਰ ਦੇ ਹੈ ਅਤੇ ਤੇਜ਼ ਰਫਤਾਰ ਨਾਲ ਵੱਧ ਰਿਹਾ ਹੈ ਦੇਸ਼ ਦੇ ਮਨੋਰੰਜਨ ਦੇ ਸਭ ਤੋਂ ਪ੍ਰਸਿੱਧ ਰੂਪ ਖੇਡਾਂ ਸਿਨੇਮਾ ਘਰ ਲੋਕ ਨਾਚ ਆਦਿ ਹਨ ਭਾਰਤ ਵਿੱਚ ਲੋਕ ਸਭ ਤੋਂ ਜ਼ਿਆਦਾ ਸਿਨੇਮਾ ਵੇਖਣਾ ਪਸੰਦ ਕਰਦੇ ਹਨ